ਹਾਂ ਅਨੰਤ ਗੱਲ ਕਰ ਰਹੇ ਓਂ ਹਾਂਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਓ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ ਬਸ ਅੱਜ ਹੁਣ ਵਾਲੀ ਗੱਲ ਕਰਨੀ ਸੀਗੀ ਆਪਣੇ ਬੱਚਿਆਂ ਦੀ ਤੁਹਾਨੂੰ ਪਤਾ ਹੀ ਹੈ ਹੁਣ ਪਲੱਸ ਟੂ ਕਲੀਅਰ ਹੋ ਚੁੱਕੀ ਹੈ ਅਤੇ ਹੁਣ ਅੱਗੇ ਉਹਨਾਂ ਨੂੰ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਉਣੀ ਸੀ ਅਤੇ ਮੈਂ ਚਲੋ ਤੁਹਾਡੇ ਨਾਲ ਵੀ ਗੱਲ ਕਰ ਲਾ ਮੈਂ ਹਾਂਜੀ ਤੁਹਾਨੂੰ ਪਤਾ ਕਿ ਆਪਣੇ ਹਾਂਜੀ ਹਾਂਜੀ ਹੁਣ ਇੱਦਾਂ ਮੈਂ ਵੀ ਚਲੋ ਮੈਂ ਤੁਹਾਡੇ ਨਾਲ ਗੱਲ ਕਰਦਾ ਜਿੱਦਾਂ ਕਿ ਆਪਣੇ ਬੱਚੇ ਸ਼ੁਰੂ ਤੋਂ ਹੀ ਇਕੱਠੇ ਪੜ੍ਹਦੇ ਆ ਰਹੇ ਆ ਟੈਂਨਥ ਕਲੀਅਰ ਹੋ ਗਈ ਉਹਨਾਂ ਦੀ ਹੁਣ ਹਾਂਜੀ ਜਿੱਦਾਂ ਕਿ ਹੁਣ ਬੱਚੇ ਦਾ ਆਪਣੇ ਬੱਚੇ ਦਾ ਵੀ ਇੰਟਰਸਟ ਪੁੱਛਿਆ ਸੀ ਕਿ ਉਹਨੂੰ ਕਿਹੜਾ ਸਬਜੈਕਟ ਵਧੀਆ ਲੱਗਦਾ ਆ ਕਿਹੜੇ 'ਚ ਅੱਗੇ ਉਹਨੇ ਜਾਣਾ ਆ ਕੀ ਉਹਦਾ ਡਰੀਮ ਹੈ ਅਤੇ ਮੈਂ ਚਲ ਮੈਂ ਤੁਹਾਡੇ ਨਾਲ ਗੱਲ ਕਰਦਾ ਤੁਸੀਂ ਪੁੱਛਿਆ ਸੀ ਆਪਣੇ ਬੱਚੇ ਬਾਰੇ ਉਹਦੇ ਨਾਲ ਗੱਲ ਕੀਤੀ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਿੱਦਾਂ ਕਿ ਮੈਂ ਬੱਚੇ ਦਾ ਪੁੱਛਿਆ ਸੀ ਮੇਰਾ ਬੱਚਾ ਪੜ੍ਹਨ 'ਚ ਥੋੜ੍ਹਾ ਵਧੀਆ ਆਪਣੇ ਦੋਨੋਂ ਬੱਚੇ ਵਧੀਆ ਪੜ੍ਹਦੇ ਆ ਹਾਂਜੀ ਅਤੇ ਮੈਂ ਅਤੇ ਉੱਥੇ ਅਗਰ ਉਹਨਾਂ ਨੂੰ ਆਪਾਂ ਮੈਡੀਕਲ ਸਟਰੀਮ ਰੱਖਵਾਂ ਦਿੰਦੇ ਹਾਂ ਇੱਥੇ ਫਤਿਹਗੜ ਸਾਹਿਬ ਦੇ ਵਿੱਚ ਸਕੂਲ ਕਾਫੀ ਵ ਜ਼ਿਆਦਾ ਵਧੀਆ ਨੇ ਹਾਂਜੀ ਮੈਂ ਤੈਨੂੰ ਦੋ ਚਾਰ ਸਕੂਲ ਦੇ ਨੇਮ ਦੱਸਦਾ ਫਿਰ ਆਪਾਂ ਦੇਖ ਲੈਂਦੇ ਬੱਚੇ ਨੂੰ ਕਿਹੜੇ ਸਕੂਲ ਦੇ ਵਿੱਚ ਲਗਾਉਣਾ ਆ ਅਤੇ ਕਿਹੜਾ ਸਟਰੀਮ ਰੱਖਣਾ ਆ ਹਾਂਜੀ ਜਿਵੇਂ ਕਿ ਇੱਕ ਸਕੂਲ ਹੈਗਾ ਸੈਵਰਨ ਸਿਟੀ ਹੈ ਸੈਵਰਨ ਸਕੂਲ ਏ ਅਤੇ ਹਾਂਜੀ ਇੱਕ ਹੈਗਾ ਮੋਡਰਨ ਸਕੂਲ ਹੈ ਇੱਕ ਬਲੂਸਮ ਸਕੂਲ ਆ ਇੱਧਰ ਆਪਣੇ ਹਾਂਜੀ ਇੱਕ ਮੋ ਇੱਕ ਪੈਰਾਸਮ ਸਕੂਲ ਹੈ ਸਕੂਲ ਮਤਲਬ ਫ਼ਤਹਿਗੜ੍ਹ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਅਤੇ ਵਧੀਆ ਸਕੂਲ ਨੇ ਹਾਂਜੀ ਜਿੱਦਾਂ ਕਿ ਜਿਹੜਾ ਬਲੂਸਮ ਸਕੂਲ ਹੈ ਅਤੇ ਸੈਵਰਨ ਸਕੂਲ ਹੈ ਦੋਨੋਂ ਸਕੂਲ ਬਹੁਤ ਬੈਸਟ ਨੇ ਆਪਣੇ ਬੱਚਿਆਂ ਦੇ ਲਈ ਹਾਂਜੀ ਨੋਨ ਮੈਡੀਕਲ ਦੇ ਵਿੱਚ ਆਪਾਂ ਇਹਨਾਂ ਨੂੰ ਸਟਰੀਮ ਦੇ ਵਿੱਚ ਐਡਮਿਸ਼ਨ ਕਰਵਾ ਦਿੰਦੇ ਹਾਂ ਅਤੇ ਬੱਚੇ ਦਾ ਸਕੋਪ ਵੀ ਵਧੀਆ ਰਹੇਗਾ ਅਤੇ ਵਧੀਆ ਅੱਗੇ ਡਰੀਮ ਵੀ ਵਧੀਆ ਕੰਪਲੀਟ ਕਰ ਲੈਣਗੇ ਆਪਣੇ ਹਾਂਜੀ ਬਾਕੀ ਇਹਨਾਂ ਦਾ ਜਿਹੜਾ ਫੀਸ ਸਟਰਕਚਰ ਆ ਉਹ ਵੀ ਬਹੁਤ ਵਧੀਆ ਮਤਲਬ ਬਹੁਤ ਲੋਅ ਲੈਵਲ ਅਤੇ ਫੀਸ ਲੈਂਦੇ ਆ ਬਾਕੀ ਸਾਰਾ ਸਟਾਫ ਵੀ ਵਧੀਆ ਇੱਥੇ ਦਾ ਅਤੇ ਸਟੱਡੀ ਵੀ ਬਹੁਤ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਹਾਂਜੀ ਤਾਂ ਆਪਾਂ ਇੱਦਾਂ ਹੀ ਕਰਦੇ ਹਾਂ ਆਪਾਂ ਕੱਲ੍ਹ ਆਪਣੇ ਬੱਚਿਆਂ ਨੂੰ ਲੈ ਕੇ ਨਾ ਸਕੂਲ ਦੇ ਵਿੱਚ ਜਾ ਕੇ ਵਿਜਿਟ ਕਰਕੇ ਆਉਂਦੇ ਹਾਂ ਅਤੇ ਜੇ ਉਹਨਾਂ ਦੇ ਪ੍ਰਿੰਸੀਪਲ ਸਰ ਜਾਂ ਮੈਡਮ ਨਾਲ ਐਡਮਿਸ਼ਨ ਦੀ ਗੱਲ ਕਰ ਆਵਾਂਗੇ ਹਾਂਜੀ ਅਤੇ ਆਪਾਂ ਕੱਲ੍ਹ ਦੇਖ ਲੈਂਦੇ ਹਾਂ ਬੱਚਿਆਂ ਨੂੰ ਨਾਲ ਲੈ ਜਾਂਦੇ ਹਾਂ ਮੋਰਨਿੰਗ ਦਸ ਕੁ ਵਜੇ ਹਾਂਜੀ ਨਾਲੇ ਆਪਾਂ ਨੂੰ ਬੱਚਿਆਂ ਦੇ ਇੰਟਰਸਟ ਪਤਾ ਲੱਗ ਜਾਏਗਾ ਜਿੱਥੇ ਇਹਨਾਂ ਨੂੰ ਲੱਗਿਆ ਕਿ ਹਾਂ ਸਾਡਾ ਸਟਰੀਮ ਅਸੀਂ ਇਹ ਚੂਜ ਕਰਨਾ ਅਤੇ ਉਹ ਦੇਖ ਲੈਣਗੇ ਅਤੇ ਆਪਾਂ ਨੂੰ ਜਿਹੜਾ ਸਕੂਲ ਸਹੀ ਲੱਗੇਗਾ ਅਤੇ ਆਪਣੇ ਬੱਚਿਆਂ ਦੀ ਆਪਾਂ ਐਡਮਿਸ਼ਨ ਕਰਵਾ ਦਾਂਗੇ ਸਕੂਲ ਹਾਂਜੀ ਸਕੂਲ ਇੱਕ ਇੱਧਰ ਹੈਗਾ ਮੋਡਰਨ ਸਕੂਲ ਹੈ ਹਾਂਜੀ ਬਟ ਉੱਥੇ ਤਾਂ ਥੋੜ੍ਹਾ ਜਿਹਾ ਸਿਲੇਬਸ ਥੋੜ੍ਹਾ ਜਿਹਾ ਟਫ ਹੈ ਹਾਂਜੀ ਚਲੋ ਫਿਰ ਕੱਲ੍ਹ ਬੱਚੇ ਨੂੰ ਆਪਾਂ ਲੈ ਕੇ ਜਾਂਦੇ ਹਾਂ ਸਵੇਰੇ ਹਾਂ ਠੀਕ ਹੈ ਵੀਰ ਜੀ ਓਕੇ